ਹਾਂਜੀ ਸਾਡੇ ਅ ਭਾਰਤ ਵਿੱਚ ਕੁਝ ਕੁ ਇੱਦਾਂ ਦੇ ਵਿਸ਼ੇ ਹਨ ਜਿੰਨਾਂ 'ਤੇ ਮੈਂ ਲਿਖਣਾ ਚਾਹੁੰਦੀ ਹਾਂ ਪਰ ਬਹੁਤ ਸ਼ੱਕੀ ਵੀ ਹੈਂ ਜਿਵੇਂ ਕਿ ਆਪਾਂ ਸੋਚਿਆ ਜਾਵੇ ਕਿ ਕੁੜੀਆਂ ਦੀ ਕੋਈ ਵੀ ਔਰਤਾਂ ਲਈ ਕੋਈ ਵੀ ਸੇਫਟੀ ਵਾਲੇ ਉਹਨਾਂ ਦੇ ਕੋਈ ਵੀ ਰੂਲਸ ਨਹੀਂ ਬਣੇ ਹੋਏ ਔਰਤ ਕਿਤੇ ਵੀ ਸੇਫ ਨਹੀਂ ਫੀਲ ਕਰਦੀ ਜਦੋਂ ਵੀ ਉਹ ਕਿਤੇ ਬਾਹਰ ਜਾਂਦੀ ਐ ਉਸਨੂੰ ਬਹੁਤ ਡਰ ਫੀਲ ਹੁੰਦਾ ਹੈ ਕਿ ਕੋਈ ਉਸਨੂੰ ਨਾਲ ਕੁਛ ਗਲਤ ਨਾ ਕਰ ਦਵੇ ਕੁਛ ਉਸਨੂੰ ਅਪਸ਼ਬਦ ਨਾ ਬੋਲ ਦੇ ਇਸ ਲਈ ਇਹ ਬਹੁਤ ਹੀ ਇੱਕ ਵਿਸ਼ਾ ਜਿਸ 'ਤੇ ਮੈਂ ਬਹੁਤ ਇਹ ਇਸ 'ਤੇ ਕੁਛ ਕੁ ਮੈਂ ਇਹ ਚਾਹੁੰਦੀ ਹੈ ਕਿ ਔਰਤਾਂ ਦੀ ਸੇਫਟੀ ਲਈ ਕੁਛ ਕੁ ਵਧੀਆ ਰੂਲਸ ਬਣੇ ਹੋਣੇ ਚਾਹੀਦੇ ਆ ਕੋਈ ਸਟਰਿਕਟ ਰੂਲ ਬਣੇ ਹੋਣੇ ਚਾਹੀਦੇ ਹੈ ਇਹ ਅੱਜ ਕੱਲ੍ਹ ਔਰਤ ਦੀ ਸੇਫਟੀ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਔਰਤ ਹੈ ਜੋ ਉਹ ਆਪਣੇ ਆਪ ਨੂੰ ਬਾਹਰ ਜਾਣ ਤੋਂ ਪਹਿਲਾਂ ਸੇਫ ਜ਼ਰੂਰ ਫੀਲ ਕਰੇ